ਭਾਰਤ ਦੀ ਜਿਹੜੀ ਸਿੱਖਿਆ ਪ੍ਰਣਾਲੀ ਹੈ ਉਹ ਬਹੁਤ ਵਧੀਆ ਹੈ ਪਰ ਕੁਛ ਕੁਛ ਚੀਜ਼ਾਂ ਦੇ ਵਿੱਚ ਜਿਹੜੀਆਂ ਹੈ ਕਮੀਆਂ ਪਾਈਆਂ ਜਾਂਦੀਆਂ ਹੈ ਜਿਵੇਂ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਪਰ ਅੱਜ ਕੱਲ੍ਹ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਲੋਕਾਂ ਦਾ ਰੁਝਾਨ ਅੰਗਰੇਜ਼ੀ ਵੱਲ ਜਿਹੜਾ ਜ਼ਿਆਦਾ ਵੱਧ ਗਿਆ ਹੈ ਉਹ ਆਪਣੀ ਭਾਸ਼ਾ ਨੂੰ ਛੱਡ ਕੇ ਜਿਹੜਾ ਅੰਗਰੇਜ਼ੀ ਵੱਲ ਆਪਣਾ ਰੁਝਾਨ ਜ਼ਿਆਦਾ ਵਧਾ ਰਹੇ ਹੈ ਹੋਰ ਦੇਸ਼ਾਂ ਦੇ ਵਿੱਚ ਆਪਣੀ ਮਾਤ ਭਾਸ਼ਾ ਨੂੰ ਜਿਹੜੀ ਹੈ ਉਹ ਪਹਿਲ ਦਿੱਤੀ ਜਾਂਦੀ ਹੈ ਪਰ ਸਾਡੇ ਦੇਸ਼ ਦੇ ਵਿੱਚ ਜਿਹੜਾ ਹੈ ਉਹ ਅੰਗਰੇਜ਼ੀ ਵੱਲ ਜਿਹੜਾ ਬੱਚੇ ਆ ਉਹ ਰੁਝਾਨ ਜ਼ਿਆਦਾ ਵਧਾ ਰਹੇ ਹੈ ਆ ਜਿਵੇਂ ਕਿ ਸਾਡੇ ਜਿਹੜੀ ਹੈ ਪ੍ਰੈਕਟੀਕਲ ਨੋਲੇਜ ਘੱਟ ਦੇ ਕੇ ਜਿਹੜੀ ਹੈ ਦੂਸਰੀ ਸਾਨੂੰ ਥਿਊਰੀ ਜ਼ਿਆਦਾ ਕਰਵਾਈ ਜਾਂਦੀ ਹੈ ਜੋ ਕਿ ਸਾਨੂੰ ਜਦੋਂ ਅਸੀਂ ਆਪਣੀ ਜੌਬ ਦੇ ਵਿੱਚ ਆਉਂਦੇ ਹਾਂ ਤਾਂ ਸਾਨੂੰ ਇਹ ਚੀਜ਼ਾਂ ਦਾ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਓਨਾ ਕੋਈ ਫਾਇਦਾ ਨਹੀਂ ਹੈ ਇਸ ਕਰਕੇ ਸਾਡੇ ਜਿਹੜੇ ਹੈ ਇਸ ਚੀਜ਼ 'ਚ ਸੁਧਾਰ ਚਾਹੀਦਾ ਕਿ ਜਿਹੜੀ ਜ਼ਿਆਦਾ ਤੋਂ ਜ਼ਿਆਦਾ ਹੈ ਉਹ ਪ੍ਰੈਕਟੀਕਲ ਚੀਜ਼ਾਂ ਪੜ੍ਹਾਈਆਂ ਜਾਣ